ਅਸੀਂ ਆਪਣੇ ਪੌਦਿਆਂ ਦੀ ਪੈਦਾਵਾਰ ਦੇ ਲਈ ਬਹੁਤ ਜ਼ਿਆਦਾ ਸਾਵਧਾਨੀਆਂ ਵਰਤਣੀਆਂ ਪੈਂਦੀਆਂ ਹਨ ਕਈ ਵਾਰ ਜ਼ਿਆਦਾ ਖਾਦਾਂ ਪਾਉਣ ਨਾਲ ਵੀ ਪੌਦਿਆਂ ਦਾ ਨੁਕਸਾਨ ਹੋ ਜਾਂਦਾ ਹੈ ਇਸ ਵਿੱਚ ਕਈ ਪ੍ਰਕਾਰ ਏ ਯੂਰੀਆ ਜਾਂ ਡੀ ਏ ਪੀ ਖਾਦਾਂ ਪਾਉਣ ਨਾਲ ਆਪਣੇ ਬੂਟਿਆਂ ਦਾ ਵਿਕਾਸ ਰੁਕ ਜਾਂਦਾ ਹੈ ਅਤੇ ਉਹ ਖਰਾਬ ਹੋ ਜਾਂਦੇ ਹਨ

ਗਵਾਰਾ ਆਦਿ ਇਹਨਾਂ ਦਾ ਬਹੁਤ ਧਿਆਨ ਰੱਖਣਾ ਪੈਂਦਾ ਹੈ ਇਸ ਇਸ ਵਿੱਚ ਕਈ ਵਾਰ ਜ਼ਿਆਦਾ ਰੂੜੀ ਦੀ ਖਾਦ ਜਾਂ ਬਾਇਓ ਖਾਦ ਪਾਉਣ ਨਾਲ ਵੀ ਖਰਾਬ ਹੋ ਜਾਂਦੀਆਂ ਹਨ ਕਈ ਪ੍ਰਕਾਰ ਦੀਆਂ ਹੋਰ ਫਸਲਾਂ ਖੇਤ ਵਿੱਚ ਜ਼ਿਆਦਾ ਪਾਣੀ ਭਰ ਜਾਣ ਨਾਲ ਵੀ ਖਰਾਬ ਹੋ ਜਾਂਦੀਆਂ ਨੇ ਇਸ ਨਾਲ ਇਹਨਾਂ ਨੂੰ ਸਮੇਂ ਅਨੁਸਾਰ ਬਹੁਤ ਘੱਟ ਪਾਣੀ ਦੀ ਲੋੜ ਪੈਂਦੀ ਹੈ ਇਸ ਦੇ ਨਾਲ ਨਾਲ ਸਾਨੂੰ ਆਪਣੇ ਖੇਤ ਦੇ ਆਲੇ ਦੁਆਲੇ ਹੋਰ ਆਲੇ ਦੁਆਲੇ ਤੋਂ ਵਾਧੂ ਪਾਣੀ ਨਹਿਰਾਂ ਦਾ ਟੁੱਟਣ ਤੋਂ ਵੀ ਬਚਾ ਕੇ ਸੰਭਾਲ ਰੱਖਣੀ ਪੈਂਦੀ ਹੈ ਜਿਸ ਨਾਲ ਜ਼ਿਆਦਾ ਨੁਕਸਾਨ ਹੋ ਜਾਂਦਾ ਹੈ ਇਸ ਦੇ ਨਾਲ ਨਾਲ ਸਾਨੂੰ ਆਪਣੇ ਘਰ ਵਿੱਚ ਵੀ ਲਗਾਏ ਹੋਏ ਪੌਦਿਆਂ ਦਾ ਧੁੱਪ ਜ਼ਿਆਦਾ ਧੁੱਪ ਤੋਂ ਵੀ ਸੰਭਾਲ ਕੇ ਰੱਖਣਾ ਪੈਂਦਾ ਹੈ ਜਿਸ ਨਾਲ ਇਹ ਮੱਚ ਜਾਂਦੇ ਹਨ ਧੰਨਵਾਦ ਸਹਿਤ